ਜਦੋਂ ਅਸੀਂ ਸੈਰ ਸਪਾਟਾ ਕਰਦੇ ਹਾਂ ਭਾਵੇਂ ਉਹ ਆਪਣੇ ਰਾਜ ਵਿੱਚ ਹੋਵੇ ਆਪਣੇ ਸ਼ਹਿਰ ਵਿੱਚ ਹੋਵੇ ਤਾਂ ਭਾਵੇਂ ਉਹ ਕਿਸੇ ਬਾਹਰਲੇ ਸ਼ਹਿਰ ਵਿੱਚ ਹੋਵੇ ਉਦੋਂ ਅਸੀਂ ਸੈਰ ਸਪਾਟਾ ਕਰਨ ਦੇ ਨਾਲ ਨਾਲ ਉਸ ਥਾਂ ਦੇ ਉੱਤੇ ਘੁੰਮਾਂਗੇ ਫਿਰਾਂਗੇ ਕੁਛ ਖਾਵਾਂਗੇ ਅਤੇ ਕੁਛ ਖਰੀਦਾਂਗੇ ਵੀ ਜਿਹਦੇ ਨਾਲ ਕਿ ਸਥਾਪਕ ਸਥਾਨਿਕ ਕਾਰੋਬਾਰਾਂ ਨੂੰ ਮਦਦ ਮਿਲਦੀ ਹੈ ਸਥਾਨਕ ਕਾਰੋਬਾਰ ਕਈ ਤਾਂ ਬਿਲਕੁਲ ਹੀ ਟੂਰਿਸਟ 'ਤੇ ਡਿਪੈਂਡ ਹੁੰਦੇ ਹਨ ਜਿਵੇਂ ਮਨਾਲੀ ਮਸੂਰੀ ਵਰਗੀਆਂ ਜਗਾਵਾਂ ਸਿਰਫ਼ ਗਰਮੀ ਵਿੱਚ ਹੀ ਖੁੱਲਦੀਆਂ ਹਨ ਉਹ ਗਰਮੀ ਵਿੱਚ ਹੀ ਆਪਣਾ ਬਿਜ਼ਨਸ ਚਲਾ ਸਕਦੇ ਹਨ ਬਾਅਦ ਵਿੱਚ ਬਰਫ਼ ਡਿੱਗਣ ਵੇਲੇ ਤਾਂ ਉਹਨਾਂ ਦੇ ਸਥਾਨਕ ਕਾਰੋਬਾਰ ਬੰਦ ਠੱਪ ਹੀ ਰਹਿੰਦੇ ਹਨ ਇਸ ਕਰਕੇ ਜਦੋਂ ਵੀ ਸੈਰ ਸਪਾਟੇ 'ਤੇ ਜਾਓ ਤਾਂ ਇਹਨਾਂ ਲੋਕਾਂ ਦੀ ਮਦਦ ਕਰੋ ਵੈਸੇ ਵੀ ਸਥਾਨਕ ਕਾਰੋਬਾਰਾਂ ਦੇ ਉੱਤੇ ਜ਼ਿਆਦਾ ਭਰੋਸਾ ਹੁੰਦਾ ਹੈ ਔਨਲਾਈਨ ਚੀਜ਼ ਮੰਗਵਾਉਣ ਨਾਲੋਂ ਸਥਾਨਕ ਕਾਰੋਬਾਰਾਂ ਵਾਲਿਆਂ ਕੋਲੋਂ ਲੈਣਾ ਵੱਧ ਫਾਇਦੇਮੰਦ ਸਾਬਿਤ ਹੁੰਦਾ ਹੈ ਤੁਸੀਂ ਇਹਨਾਂ ਨੂੰ ਜੇ ਕੋਈ ਚੀਜ਼ ਮਾੜੀ ਲੱਗੇ ਤੁਸੀਂ ਵਾਪਿਸ ਵੀ ਕਰ ਸਕਦੇ ਹੋ ਅਤੇ ਉਹ ਵੀ ਲੋਕ ਚੰਗੇ ਹੁੰਦੇ ਹਨ ਜੋ ਵਾਪਿਸ ਕਰ ਲੈਂਦੇ ਹਨ ਥੋੜ੍ਹੇ ਪੈਸੇ ਘੱਟ ਵੀ ਲੈ ਲੈਂਦੇ ਹਨ ਬਟ ਔਨਲਾਈਨ ਵਿੱਚ ਕਿਸੇ ਦਾ ਕੋਈ ਭਰੋਸਾ ਨਹੀਂ